ਜੀ ਹਾਂ ਮੈਂ ਇੱਕ ਆਪਣੀ ਯਾਦਗਾਰੀ ਗਾਇਕਾ ਅਨੁਭਵ ਦਾ ਵਰਣਨ ਦਾ ਦੇ ਸਕਦੀ ਹਾਂ ਸਾਡੇ ਸਕੂਲ ਵਿੱਚ ਇੱਕ ਵਾਰੀ ਇੱਕ ਗਾਇਕ ਆਏ ਹਨ ਉਹਨਾਂ ਦਾ ਨਾਮ ਸੀਗਾ ਸਰਤਿੰਦਰ ਸਰਤਾਜ ਉਹਨਾਂ ਨੇ ਆ ਕੇ ਆਪਣਾ ਇੱਕ ਪੂਰਾ ਸ਼ੋ ਕੀਤਾ ਹੈ ਜਿਸ ਨੂੰ ਮੈਂ ਦੇਖ ਕੇ ਪੂਰੀ ਪਾਗਲ ਹੋ ਗਈ ਸੀ ਕਿਉਂਕਿ ਮੈਂ ਪਹਿਲੀ ਵਾਰ ਆਹਮੋ ਸਾਹਮਣੇ ਕਿਸੇ ਵੀ ਗਾਇਕ ਨੂੰ ਵੇਖਿਆ ਸੀ ਅਤੇ ਮੈਨੂੰ ਉਹਨਾਂ ਦੀ ਗਾਇਕਾ ਬਹੁਤ ਵਧੀਆ ਲੱਗੀ ਮੈਂ ਵੀ ਇੱਕ ਗਾਇਕ ਹਾਂ ਮੈਨੂੰ ਵੀ ਥੋੜ੍ਹਾ ਬਹੁਤਾ ਗਾਉਣਾ ਆਉਂਦਾ ਹੈ ਪਰ ਉਹਨਾਂ ਨੂੰ ਸਾਹਮਣੇ ਰੂਬਰੂ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਿਲੀ ਮੈਨੂੰ ਉਹਨਾਂ ਤੋਂ ਬਹੁਤ ਕੁਛ ਦੇਖਣ ਤੋਂ ਸਿੱਖਣ ਤੋਂ ਮਿਲਿਆਂ ਕਿ ਉਹਨਾਂ ਨੇ ਗਾਇਕੀ ਵਿੱਚ ਕੀ ਕੀ ਕੀਤਾ ਹੈ ਅਤੇ ਉਹਨਾਂ ਨੇ ਕੀ ਕੀ ਮੁਕਾਮ ਹਾਸਿਲ ਕੀਤੇ ਹਨ ਸਾਡੇ ਬਹੁਤ ਸਾਰੇ ਵੱਡੇ ਵੱਡੇ ਗਾਇਕ ਹਨ ਜੋ ਬਚਪਨ ਤੋਂ ਹੀ ਗਾਇਕ ਨਹੀਂ ਸੀ ਬਚਪਨ ਤੋਂ ਹੀ ਬਹੁਤ ਪ੍ਰਸਿੱਧ ਨਹੀਂ ਹੈਗੇ ਪਰ ਉਹਨਾਂ ਨੇ ਆਪਣੀ ਗਾਇਕਾ ਨਾਲ ਹੀ ਆਪਣੇ ਆਪ ਨੂੰ ਪ੍ਰਸਿੱਧ ਕੀਤਾ ਹੈ ਇਸੇ ਪ੍ਰਕਾਰ ਮੈਂ ਸਤਿੰਦਰ ਸਰਤਾਜ ਨੂੰ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਈ ਹਾਂ ਮੈਨੂੰ ਸਿੱਖਿਆ ਮਿਲਦੀ ਹੈ ਕਿ ਮੈਨੂੰ ਕੁਛ ਵੀ ਕਰਨ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਪ੍ਰੈਕਟਿਸ ਕਰਨੀ ਪੈਣੀ ਹੈ ਅਗਰ ਮੈਂ ਇਹ ਨਹੀਂ ਕਰਦੀ ਹਾਂ ਤਾਂ ਮੈਂ ਕਦੇ ਵੀ ਗਾਇਕ ਨਹੀਂ ਬਣ ਸਕਦੀ ਹਾਂ ਗਾਇਕਾ ਗਾਇਕਾ ਬਣਨ ਵਾਸਤੇ ਸਾਨੂੰ ਗਲੇ ਨੂੰ ਸਾਫ ਰੱਖਣਾ ਚਾਹੀਦਾ ਹੈ ਸਾਡਾ ਗਲਾ ਇਕਦਮ ਸਾਫ ਹੋਣਾ ਚਾਹੀਦਾ ਹੈ ਸਾਨੂੰ ਕੋਈ ਵੀ ਊਟ ਪਟਾਂਗ ਚੀਜ਼ਾਂ ਨਹੀਂ ਖਾਣੀ ਚਾਹੀਦੀਆਂ ਹਨ ਜਿਸ ਕਾਰਨ ਸਾਡੇ ਗਲੇ 'ਤੇ ਪ੍ਰਭਾਵ ਪਵੇ ਕਿਉਂਕਿ ਗਾਇਕਾਂ ਵਿੱਚ ਸਭ ਤੋਂ ਜ਼ਿਆਦਾ ਅਗਰ ਕੁਛ ਇੰਪੋਰਟੈਂਟ ਹੈ ਤਾਂ ਉਹ ਗਲਾਂ ਹੀ ਹੈ ਅਤੇ ਗਲੇ ਨੂੰ ਹੀ ਆਪਾਂ ਸੁਧਾਰ ਸਕਦੇ ਹਾਂ ਅਲ ਵਧੀਆ ਵਧੀਆ ਚੀਜ਼ਾਂ ਖਾ ਕੇ ਗਰਮ ਪਾਣੀ ਪੀ ਕੇ